ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿੱਥੋਂ ਬੋਲਦੇ ਹੋ ਜੀ ਅੱਛਾ ਹਾਂਜੀ ਦੱਸੋ ਹਾਂਜੀ ਹਾਂਜੀ ਹਾਂਜੀ ਇੱਥੋਂ ਦਾ ਮਾਹੌਲ ਵਧੀਆ ਜੀ ਇੱਥੋਂ ਦਾ ਵਾਤਾਵਰਨ ਵੀ ਤੁਹਾਨੂੰ ਵਧੀਆ ਮਿਲੂਗਾ ਅਤੇ ਹੋਰ ਇੱਥੋਂ ਦੇ ਮਤਲਬ ਕਿ ਜਿਹੜੇ ਵੀ ਲੋਕ ਆ ਰਹਿੰਦੇ ਆ ਆਪ ਮਤਲਬ ਕਿ ਉਹਨਾਂ 'ਚ ਭਾਈਚਾਰਾ ਹੈਗਾ ਹੈ ਰਿਸ਼ਤੇ ਵਧੀਆ ਨਿਭਾਉਂਦੇ ਆ ਸਭ ਕੁਛ ਮਤਲਬ ਤੁਹਾਨੂੰ ਵਧੀਆ ਸਹੂਲਤਾਂ ਮਿਲਣਗੀਆਂ ਇੱਥੇ ਹਾਂਜੀ ਹੋਰ ਨਹੀਂ ਨਹੀਂ ਤੁਹਾਨੂੰ ਸਫ਼ਰ ਦੀ ਵੀ ਵਧੀਆ ਸਹੂਲਤ ਮਿਲੂਗੀ ਕੋਈ ਮਤਲਬ ਕਿ ਇੱਦਾਂ ਰਿਸਕ ਨਹੀਂ ਹੋਊਗਾ ਮਿਲੂਗਾ ਕੋਈ ਵੀ ਵਧੀਆ ਸਭ ਕੁਝ ਹੋਊਗਾ

ਹਾਂਜੀ ਹਾਂਜੀ ਹਾਂਜੀ ਹਾਂਜੀ ਇੱਥੋਂ ਸ ਸਭ ਮਤਲਬ ਕਿ ਵਧੀਆ ਰਹਿੰਦੇ ਆ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਊਗੀ ਸਭ ਮਤਲਬ ਕਿ ਜੇ ਮੰਨ ਕੇ ਚੱਲੋ ਤੁਹਾਨੂੰ ਕੋਈ ਅ ਪਰੋਬ ਪਰੇਸ਼ਾਨੀ ਆਉਂਦੀ ਆ ਤਾਂ ਉਹ ਮਤਲਬ ਕਿ ਤੁਹਾਡਾ ਤੁਹਾਡੀ ਮਦਦ ਜ਼ਰੂਰ ਕਰਨਗੇ ਇੱਥੋਂ ਦਾ ਮਤਲਬ ਕਿ ਸਭ ਕੁਝ ਸਭ ਵਧੀਆ ਹੈਗੇ ਆ ਜੀ ਠੀਕ ਹੈ ਠੀਕ ਹੈ ਜੀ